ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਹੋਰ ਸਭ ਵਧੀਆ ਜੀ ਭਾਅ ਜੀ ਆਰ ਕੇ ਇੰਟਰਪ੍ਰਾਈਜ਼ਸ ਤੋਂ ਬੋਲਦੇ ਹੈਗੇ ਹੈ ਮੈਂ ਭਾਅ ਜੀ ਤੁਹਾਡੀ ਦੁਕਾਨ ਤੋਂ ਐਪਲ ਦਾ ਮੋਬਾਈਲ ਔਡਰ ਕੀਤਾ ਸੀਗਾ ਆਈ ਫੋਨ ਟੈਨ ਉਹ ਭਾਅ ਜੀ ਬੜਾ ਉਹਦੀ ਜਦ ਇੱਕ ਤਾਂ ਮੈਨੂੰ ਪਹਿ ਸਭ ਤੋਂ ਪਹਿਲਾਂ ਉਹਦੀ ਡਿਲੀਵਰੀ ਬੜੀ ਟਾਈਮ ਨਾਲ ਮਿਲੀ ਹੈਗੀ ਹੈ ਭਾਅ ਜੀ ਤੁਸੀਂ ਦੋ ਦਿਨ ਬਾਅਦ ਕਿਹਾ ਤਾ ਉਹ ਦੋ ਦਿਨ ਪਹਿਲਾਂ ਹੀ ਮਿਲ ਗਈ ਹੈਗੀ ਹੈ ਭਾਅ ਜੀ ਮੈਨੂੰ ਹਫ਼ਤੇ ਦਾ ਟਾਈਮ ਦਿੰਦੇ ਹੈਗੇ ਜਿੱਦਾਂ ਤੁਸੀਂ ਉਤੇ ਇਲਾਵਾ ਭਾਅ ਜੀ ਉਹਦੀ ਪੈਕਿੰਗ ਵੀ ਬੜੀ ਵਧੀਆ ਕੀਤੀ ਵੀ ਸੀ ਤੁਹਾਡਾ ਡਿਲੀਵਰੀ ਵਾਲਾ ਬੰਦਾ ਵੀ ਬੜਾ ਘੈਂਟ ਸੀਗਾ ਭਾਅ ਜੀ ਮਿਲਣਸਾਰ ਸੀਗਾ ਉਹਦਾ ਬਿਹੇਵੀਅਰ ਵੀ ਵਧੀਆ ਸੀਗਾ ਭਾਅ ਜੀ ਉਹ ਤੋਂ ਇਲਾਵਾ ਉਹਦੇ ਵਿੱਚ ਭਾਅ ਜੀ ਫੋਨ 'ਚ ਦੇਖੋ ਜੀ ਤੁਸੀਂ ਉਹਦੀ ਕੈਮਰਾ ਕੁਆਲਿਟੀ ਬਹੁਤ ਵਧੀਆ ਸੀਗਾ ਇੱਕ ਤੁਸੀਂ ਉਹਦਾ ਜਿਹੜਾ ਗੁਰੀਲਾ ਜਿਹੜਾ ਗਲਾਸ ਕਾਰਡ ਹੁੰਦਾ ਹੈਗਾ ਉਹ ਵੀ ਭਾਅ ਜੀ ਤੁਸੀਂ ਫ੍ਰੀ ਦਿੱਤਾ ਸੀਗਾ ਮੈਨੂੰ ਉਹ ਭਾਅ ਜੀ ਉਹ ਦੇਖ ਕੇ ਬੜੀ ਖੁਸ਼ੀ ਹੋਈ ਹੈਗੀ ਭਾਅ ਜੀ ਉਹਦੀ ਸਪੀਕਰ ਕੁਆਲਿਟੀ 'ਤੇ ਉਹ ਹੈਂਗ ਵੀ ਨਹੀਂ ਹੁੰਦਾ ਹੈਗਾ ਭਾਅ ਜੀ ਉਹ ਤਾਂ ਜੇ ਭਾਅ ਜੀ ਇੱਦਾਂ ਦਾ ਹੋਰ ਆਈ ਫੋਨ ਹੋਇਆ ਨਾ ਭਾਅ ਜੀ ਮੈਨੂੰ ਜ਼ਰੂਰ ਦੱਸਿਓ ਮੈਂ ਭਾਅ ਜੀ ਜ਼ਰੂਰ ਲੈਣਾ ਚਾਹੂੰਗਾ ਉਹ ਠੀਕ ਆ ਭਾਅ ਜੀ ਧੰਨਵਾਦ ਜੀ